ਮੈਂ ਇੱਕ ਘਰੇਲੂ ਕੰਮ ਕਰਨ ਵਾਲੀ ਔਰਤ ਹਾਂ ਘਰੇਲੂ ਕੰਮ ਦੇ ਨਾਲ਼ ਨਾਲ਼ ਮੈਂ ਮੈਨੂੰ ਸ ਬਾਗਬਾਨੀ ਦਾ ਵੀ ਬਹੁਤ ਸ਼ੌਂਕ ਹੈ ਬਾਗਬਾਨੀ ਦੇ ਵਿੱਚ ਮੈਂ ਆਪਣੇ ਸਬਜ਼ੀਆਂ ਫ਼ਲ ਫੁੱਲ ਇਹਨਾਂ ਨੂੰ ਉਗਾਇਆ ਹੋਇਆ ਹੈ ਸ ਮੈਨੂੰ ਇਹ ਜਾਣਕੇ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਵੀ ਮੈਂ ਅੱਜ ਦੇ ਸਮੇਂ ਵਿੱਚ ਆਪਣੇ ਪਰਿਵਾਰ ਨੂੰ ਇੱਕ ਔਰਗੈਨਿਕ ਸਬਜ਼ੀਆਂ ਔਰਗੈਨਿਕ ਫ਼ਲ ਦੀ ਦੇ ਰਹੀ ਹਾਂ ਖਾਣ ਵਾਸਤੇ ਦੇ ਰਹੀ ਹਾਂ ਮੇਰੇ ਸ ਮੇਰੇ ਆਪਣੇ ਬਾਗ਼ ਦੇ ਵਿੱਚ ਫਲਾਂ ਦੇ ਬੂਟੇ ਕਈ ਤਰ੍ਹਾਂ ਦੇ ਲਗਾਏ ਹੋਏ ਹਨ ਉਸਦੇ ਨਾਲ਼ ਨਾਲ਼ ਮੈਂ ਮੌਸਮੀ ਸਬਜ਼ੀਆਂ ਵੀ ਉਗਾ ਰਹੀ ਹਾਂ ਜਿਵੇਂ ਕਿ ਹੁਣ ਅੱਜ ਦੇ ਮੌਸਮ ਵਿੱਚ ਮੈਂ ਆਪਣੇ ਬਾਗ ਬਾਗਬਾਨੀ ਦੇ ਵਿੱਚ ਭਿੰਡੀਆਂ ਕਰੇਲੇ ਘੀਆ ਸ ਇੱਦਾਂ ਦੀਆਂ ਸਬਜ਼ੀਆਂ ਲ ਉਗਾਈਆਂ ਹੋਈਆਂ ਹਨ ਮੈਂ ਕਦੀ ਵੀ ਬਾਜ਼ਾਰ ਤੋਂ ਸਬਜ਼ੀ ਮੁੱਲ ਨਹੀਂ ਖਰੀਦੀ ਇਸ ਤੋਂ ਬਿਨਾਂ ਮੈਂ ਮੌਸਮੀ ਫ਼ਲ ਜਿੱਦਾਂ ਸੰਤਰਾ ਕਿਨੂੰ ਬੇਰ ਅੰਬ ਇਸ ਵਾ ਵੀ ਆਪਣੇ ਪਾਰਕ ਵਿੱਚ ਉਗਾਈਆਂ ਹੋਈਆਂ ਹਨ ਮੈਂ ਆਪਣੇ ਪਾ ਇੱਕ ਘਰ ਵਿੱਚ ਇੱਕ ਪਾਰਕ ਵੀ ਬਣਾਇਆ ਹੋਇਆ ਜਿਹਦੇ ਆਲ਼ੇ ਦੁਆਲ਼ੇ ਸਾਰੇ ਫੁੱਲ ਫੁੱਲਾਂ ਦੇ ਦਰਖ਼ਤ ਲਗਾਏ ਹੋਏ ਹਨ ਬਹੁਤ ਸਾਰੇ ਫੁੱਲਾਂ ਦੇ ਪੌਦੇ ਹਨ ਜਿਹੜੇ ਕਿ ਅਲੱਗ ਅਲੱਗ ਤਰ੍ਹਾਂ ਦੇ ਮੇਰੇ ਘਰ ਨੂੰ ਇੱਕ ਤਰ੍ਹਾਂ ਨਾਲ ਸਜਾ ਰਹੇ ਹਨ